ਹਾਂਜੀ ਮੈਂ ਦੋਵੇਂ ਤਰ੍ਹਾਂ ਹੀ ਕਰਦਾ ਜੀ ਜ਼ਿਆਦਾਤਰ ਪੈੱਨ ਦੀ ਵਰਤੋਂ ਵੀ ਕਰਨੀ ਪੈਂਦੀ ਜਦੋਂ ਨੋਟਿਸ ਵਗੈਰਾ ਬਣਾਉਣੇ ਹੁੰਦੇ ਨੇ ਕਿਉਂਕਿ ਮੈਂ ਅਧਿਆਪਨ ਦਾ ਕਾਰਜ ਕਰਦਾ ਮੈਂ ਸਹਾਇਕ ਪ੍ਰੋਫੈਸਰ ਹਾਂ ਖਾਲਸਾ ਕਾਲਜ ਪਟਿਆਲਾ ਵਿਖੇ ਅਤੇ ਪੈੱਨ ਨਾਲ਼ ਵੀ ਲਿਖਦੇ ਹਾਂ ਅਤੇ ਲੈਪਟੋਪ ਨਾਲ਼ ਵੀ ਲਿਖੀ ਦਾ ਆ ਮੋਬਾਈਲ 'ਤੇ ਵੀ ਟਾਈਪ ਕਰਦੇ ਜਦੋਂ ਵਟਸਐਪ ਦੇ 'ਤੇ ਚੈਟ ਹੁੰਦੀ ਆ ਫੇਸਬੁੱਕ ਦੇ ਉੱਤੇ ਕੋਈ ਪੋਸਟ ਪਾਉਣੀ ਹੁੰਦੀ ਹੈ ਤਾਂ ਜਿਹੜੀ ਹੈਗੀ ਆ ਉਹ ਮੋਬਾਈਲ 'ਤੇ ਟਾਈਪ ਕਰਦੇ ਆ ਲੈਪਟੋਪ ਦੇ ਵਿੱਚ ਵੀ ਟਾਈਪ ਕਰਦੇ ਹਾਂ ਕੋਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਜਦੋਂ ਕਿਉਂਕਿ ਅਸੀਂ ਪ੍ਰਿੰਟਆਊਟ ਲੈਣਾ ਉਹਨੂੰ ਹ ਟਾਈਪ ਕਰਕੇ ਪ੍ਰਿੰਟ ਦੇ ਵਿੱਚ ਲੈ ਕੇ ਆਉਣਾ ਤਾਂ ਲੈਪਟੋਪ ਦੀ ਵਰਤੋਂ ਕਰਦੇ ਹੈਗੇ ਹਾਂ ਬਹੁਤ ਸਾਰੇ ਬਹੁਤ ਵਾਰ ਅਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਪਿਛਲੇ ਜੇ ਦਸ ਕੁ ਸਾਲਾਂ ਦੀ ਪੰਜ ਦਸ ਸਾਲਾਂ ਦੀ ਗੱਲ ਕਰਨੀ ਹੋਵੇ ਤਾਂ ਫੇਸਬੁੱਕ ਵਟਸਐਪ 'ਤੇ ਹੋਰ ਸੋਸ਼ਲ ਮੀਡੀਆ ਜਿਹੜੇ ਚੈਨਲ ਹੈਗੇ ਨੇ ਪਲੇਟਫੋਰਮ ਦੇ ਨੇ ਜਿਹੜੇ ਉਹਨਾਂ ਦੇ ਆਉਣ ਦੇ ਨਾਲ਼ ਲਿਖਣਾ ਜਿਹੜਾ ਹੈਗਾ ਆ ਉਹ ਮਤਲਬ ਪੈੱਨ ਦੇ ਨਾਲ਼ ਜਾਂ ਕਲਮ ਦੇ ਨਾਲ਼ ਲਿਖਣ ਦੀ ਥਾਂ ਦੇ ਉੱਤੇ ਟਾਈਪ ਕਰਨਾ ਮਤਲਬ ਜਿਹੜਾ ਹੈਗਾ ਉਹਦਾ ਰਿਵਾਜ਼ ਮੋਬਾਈਲ ਦੇ ਉੱਤੇ ਖਾਸ ਕਰਕੇ ਟਾਈਪ ਕਰਨ ਦਾ ਜਿਹੜਾ ਟਰੈਂਡ ਜਿਹੜਾ ਬਹੁਤ ਜ਼ਿਆਦਾ ਵਧਿਆ ਹੈਗਾ ਆ ਥੈਂਕ ਯੂ